ਹੈਲੋ ਹਾਂਜੀ ਨਮਸਤੇ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਤੁਸੀਂ ਕੋਈ ਨਾ ਆ ਜਿਓ ਜੀ ਕੋਈ ਨਾ ਉਹ ਫਿਰ ਡਾਕਟਰ ਨੂੰ ਦਿਖਾ ਕੇ ਆ ਜਿਓ ਤੁਸੀਂ ਇੰਨੇ ਨੂੰ ਨੇਮ ਲਿਖਾ ਦਿਓ ਵਧੀਆ ਨੇ ਜੀ ਵਧੀਆ ਦਵਾਈ ਦਿੰਦੇ ਨੇ ਪਹਿਲਾਂ ਵੀ ਮਰੀਜ਼ ਆਏ ਸੀਗੇ ਵਧੀਆ ਠੀਕ ਹਾਂਜੀ ਹਾਂਜੀ ਤੁਸੀਂ ਅੰਦਰ ਇੱਕ ਵਾਰੀ ਆ ਜਿਓ ਤੁਸੀਂ ਮੇਰੇ ਨਾਲ ਗੱਲ ਕਰ ਲਿਓ ਹਾਂਜੀ ਅੱਛਾ ਜੀ ਹਾਂਜੀ ਤੁਸੀਂ ਫਿਰ ਪੁੱਛ ਕੇ ਆ ਜਿਓ ਨਹੀਂ ਤਾਂ ਡਾਕਟਰ ਕਈ ਵਾਰ ਰਾਊਂਡ 'ਚ ਚਲੇ ਜਾਂਦੇ ਨੇ ਉਹਨਾਂ ਦਾ ਲੰਚ ਟਾਇਮ ਵੀ ਹੁੰਦਾ ਗਾ ਤੁਸੀਂ ਪਹਿਲਾਂ ਦਵਾਈ ਕਿੱਥੇ ਖਾਧੀ ਏ ਅੱਛਾ ਜੀ ਕਿੰਨੇ ਟਾਈਮ ਦੀ ਦਵਾਈ ਪੇਨ ਹੋ ਰਿਹਾ ਤੁਹਾਡੇ ਅੱਛਾ ਤੁਸੀਂ ਪਹਿਲਾਂ ਕਿੱਥੋਂ ਖਾਧੀ ਹੈ ਦਵਾਈ ਹਾਂਜੀ ਅੱਛਾ ਜੀ ਅੱਛਾ ਜੀ ਕੋਈ ਨਾ ਤੁਸੀਂ ਆ ਜਿਓ ਕੋਈ ਨਹੀਂ ਡਾਕਟਰ ਨੂੰ ਕਹਿ ਦਾਂਗੇ ਹਾਂਜੀ ਵਧੀਆ ਨੇ ਜੀ ਬਹੁਤ ਵਧੀਆ ਨੇਗੇ ਹਾਂਜੀ ਓਕੇ ਬਾਏ ਓਕੇ ਬਾਏ